ਸਤਿ ਸ਼੍ਰੀ ਅਕਾਲ ਜੀ ਔਰ ਦੱਸੋ ਜੀ ਹਾਂਜੀ ਹੋਰ ਤੁਸੀਂ ਥਾਨੂੰ ਕੀ ਚਾਹੀਦਾ ਹਾਂਜੀ ਹਾਂ ਸਾਡੇ ਕੋਲ ਹੈਗਾ ਚੋਵੀ ਕੈਰਟ ਵਾਲਾ ਵੀ ਹੈਗਾ ਬਾਈ ਕੈਰਟ ਵਾਲਾ ਵੀ ਹੈਗਾ ਤੁਸੀਂ ਦੱਸੋ ਤੁਸੀਂ ਥਾਨੂੰ ਕਿਹੋ ਜਿਹਾ ਚਾਹੀਦਾ ਪਰ ਆਪਣੇ ਅੱਛਾ ਹਾਂਜੀ ਤੁਸੀਂ ਆਪ ਪਾਣੀ ਨਾ ਸਾਡੀ ਬਹੁ ਵਗੈਰਾ ਵਾਸਤੇ ਬਣਾਉਣਾ ਹੈਗਾ ਅੱਛਾ ਆ ਦੇਖੋ ਮੈਂ ਥੋਨੂੰ ਦਿਖਾ ਦਿੰਨਾ ਦਿਖਾ ਦਿੰਨੀ ਆ ਦੇਖ ਲੈ ਤੁਸੀਂ ਕਿਹੋ ਜਿਹਾ ਤੁਹਾਨੂੰ ਪਸੰਦ ਹੈਗਾ ਤੁਸੀਂ ਅੱਜ ਚੱਲੇ ਜੋ ਵੀ ਬਣਵਾਣਾ ਦੇਖ ਲਓ ਤੁਸੀਂ ਜੋ ਤੁਹਾਨੂੰ ਪਸੰਦ ਹੈ ਥਾਨੂੰ ਪੁਰਾਣੇ ਵਾਲਾ ਡਿਜ਼ਾਇਨ ਵਾਲਾ ਚਾਹੀਦਾ ਕੱਲ ਜਿਵੇਂ ਹਲਕੀ ਵੇਟ ਦੇ ਵੀ ਚੱਲੇ ਆ ਭਾਰਾ ਦੇ ਵਿੱਚ ਚੈਨ ਵਾਲੇ ਕਿੱਟੀ ਸੈਟ ਵੀ ਚੱਲੇ ਆ ਭਾਰੀ ਸੈੱਟ ਵੀ ਹੈਗੇ ਆ ਤੇ ਵੈਸੇ ਤਾਂ ਅੱਜ ਕੱਲ ਕੁੜੀਆਂ ਵਾਸਤੇ ਲੈਣਾ ਹੋਵੇ ਤਾਂ ਭਾਰੀ ਲੈ ਲੋ ਜੇ ਕੁੜੀ ਵਾਸਤੇ ਲੈਣਾ ਤਾਂ ਹਲਕੇ ਸੈਟ ਵੀ ਹੈਗੇ ਨੇ ਕਿੱਟੀ ਸੈਟ ਵਗੈਰਾ ਚੈਨ ਸੈਟ ਵੀ ਹੈਗੇ ਨੇ ਟਿੱਤਕਾ ਵੀ ਲੈਣਾ ਟਿੱਕੇ ਵੀ ਹੈਗੇ ਸਾਡੇ ਕੋਲੋਂ ਵਧੀਆ ਡਿਜ਼ਾਇਨ ਦੇ ਜੋ ਤੁਹਾਨੂੰ ਪਸੰਦ ਆ ਬਹੁਤ ਵਧੀਆ ਡਿਜ਼ਾਇਨ ਦੇ ਆਏ ਹੋਏ ਨੇ ਤੁਸੀਂ ਹਾਂਜੀ ਕਿੰਨੇ ਤੋਲੇ ਦਾ ਕਿਵੇਂ ਜਿਆਦਾ ਹੋ ਜਾਏਗਾ ਤੁਸੀਂ ਫਿਰ ਲੈ ਲਿਆ ਜੇ ਭਾਰੀ ਵੀ ਹੈਗਾ ਉਹ ਤੁਹਾਨੂੰ ਸਹੀ ਲੱਗੇਗਾ ਨਵਾਂ ਅੱਛਾ ਦੇਖੋ ਤੁਸੀਂ ਬਣਿਆ ਬਣਾਇਆ ਦੇਖ ਲੋ ਜੇ ਬਣਿਆ ਬਣਾਇਆ ਲੈਣਾ ਤਾਂ ਨਹੀਂ ਤਾਂ ਬਣਵਾਈ ਦੇ ਫਿਰ ਅਲਗ ਪੈਸੇ ਲੱਗਦੇ ਆ ਚੰਗੀ ਜੀ ਸਾਡੇ ਇਥੇ ਸਭ ਵਧੀਆ ਮਿਲ ਜਾਂਦੇ ਨੇ ਤੁਸੀਂ ਪਸੰਦ ਕਰੋ ਅੰਗੂਠੀਆਂ ਵਿੱਚ ਵੀ ਕਾਫੀ ਡਿਜ਼ਾਇਨ ਹੈਗੇ ਆ ਟਿੱਕੇ ਤਾਂ ਸਾਡੇ ਕੋਲ ਬਹੁਤ ਜਿਆਦਾ ਵਧੀਆ ਹੈਗੇ ਆ ਵੱਡੇ ਵੀ ਹੈਗੇ ਮੱਥਾ ਕਵਰ ਹੋ ਜਾਂਦਾ ਛੋਟੇ ਵੀ ਹੈਗੇ ਜੋ ਤੁਹਾਨੂੰ ਪਸੰਦ ਉਹ ਲੈ ਲਿਆ ਜੇ ਹਾਂਜੀ ਅੱਛਾ ਹਾਂ ਉਹ ਤਾਂ ਪਾਕਿਸਤਾਨੀ ਡਿਜ਼ਾਇਨ ਹੈਗਾ ਉਹ ਤਾਂ ਬਹੁਤ ਹੀ ਵਧੀਆ ਲੱਗਦਾ ਅੱਛਾ ਤੁਸੀਂ ਆਪਣੇ ਲਈ ਵੀ ਕੁਛ ਪਸੰਦ ਕਰ ਲਓ ਤੁਸੀਂ ਤਾਂ ਫਿਰ ਵੀ ਉਹ ਮੁੰਡੇ ਦੀ ਮਾਂ ਹੋ ਤੁਹਾਨੂੰ ਤਾਂ ਲੈਣਾ ਚਾਹੀਦਾ ਕੁਝ ਪਸੰਦ ਕਰੋ ਤੁਸੀਂ ਵੀ ਹਾਂ ਤੁਸੀਂ ਪਹਿਲਾਂ ਆਪਣੀ ਬਹੂ ਵਾਸਤੇ ਦੇਖ ਲੋ ਪਸੰਦ ਕਰੋ ਕਿਹੜਾ ਡਿਜ਼ਾਇਨ ਤੁਹਾਨੂੰ ਪਸੰਦ ਆ ਰਿਹਾ ਦੇਖ ਲਓ ਰੱਖਿਓ ਕਿੰਨੇ ਘੱਟ ਡਿਜ਼ਾਇਨ ਹੈਗੇ ਵੇਖ ਲੋ ਤੁਹਾਨੂੰ ਜੋ ਪਸੰਦ ਆਉਂਦਾ ਠੀਕ ਹੈ ਤੇ ਇਸ ਦੀਆਂ ਵੇਟ ਕਰਕੇ ਕਿੰਨੀ ਦਾ ਹੁੰਦਾ ਠੀਕ ਹ ਹੋਰ ਇਹ ਤਾਂ ਹੋ ਗਿਆ ਚਾਰ ਚਾ ਤੋਲੇ ਦਾ ਹੋ ਗਿਆ ਹੋਰ ਤੁਸੀਂ ਕੁੜੀ ਵਾਸਤੇ ਵੀ ਵੇਖ ਲਓ ਜੋ ਪਸੰਦ ਕਰਨਾ ਇੱਕ ਤਾਂ ਤੁਹਾਨੂੰ ਪਸੰਦ ਆਏਗਾ ਉਹ ਆਇਆ ਕੋਈ ਪਸੰਦ ਇਹ ਹੈਗਾ ਮੇਰੇ ਖਿਆਲ ਵਿੱਚ ਵੇਟ ਕਰਕੇ ਦੱਸਦੇ ਆਂ ਹਾਂ ਢਾਈ ਲੱਖ ਦਾ ਹੋ ਗਿਆ ਆ ਦੇਖ ਲਓ ਪਸੰਦ ਕਰ ਲਓ ਉਹ ਤਾਂ ਡਿਜ਼ਾਇਨ ਬਹੁਤ ਵਧੀਆ ਵਧੀਆ ਆਏ ਹੋਏ ਨੇ ਵੇਖ ਲਓ ਪਹਿਨ ਕੇ ਦੇਖ ਲਓ ਠੀਕ ਐ ਚਾਰ ਲੱਖ ਹੋ ਗਿਆ ਭਾਰੀ ਵਾਲੇ ਲੈਣੇ ਕਿ ਦੂਸਰੀਆ ਦੋਨੋਂ ਹੀ ਦਿਖਾ ਦੀਏ ਭਾਰੀਆ ਪੰਜੇਬਾਂ ਚੰਗੀਆਂ ਲੱਗਦੀਆਂ ਹੁੰਦੀਆਂ ਨੇ ਹਾਂਜੀ ਚਾ ਹੋ ਗਏ ਟੋਟਲ ਚਾਰ ਲੱਖ ਹੋ ਗਏ ਹਾਂ ਦੇਖ ਲਓ ਜੀ ਆਪਦਾ ਹਾਂਜੀ ਹਾਂ ਠੀਕ ਹੈ ਪੰਜ ਲੱਖ ਦਾ ਹੋ ਗਿਆ ਜੀ ਠੀਕ ਐ ਜੀ